ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਮੌਸਮ ਇੱਥੇ ਗਰਮੀਆਂ ਵੀ ਆਉਂਦੀਆਂ ਗਰਮੀਆਂ ਤੋਂ ਬਾਅਦ ਬਰਸਾਤਾਂ ਫਿਰ ਇੱਥੇ ਠੰਡ ਸ਼ੁਰੂ ਹੋ ਜਾਂਦੀ ਹੈ ਨਾਲ ਹੀ ਪੱਤਝੜ ਆ ਜਾਂਦੀ ਹੈ ਫਿਰ ਇੱਥੇ ਬਸੰਤ ਰੁੱਤ ਵੀ ਆਉਂਦੀ ਹੈ ਅਤੇ ਇਹਨਾਂ ਸਭ ਫਿਰ ਉਸ ਤੋਂ ਬਾਅਦ ਬਸੰਤ ਤੋਂ ਬਾਅਦ ਫਿਰ ਗਰਮੀਆਂ ਸ਼ੁਰੂ ਹੋ ਜਾਂਦੀਆਂ ਇੱਥੇ ਰਹਿਣ ਵਾਲੇ ਲੋਕਾਂ ਦੇ ਰੋਜ਼ਾਨਾ ਜੀਵਨ 'ਤੇ ਰੁੱਤਾਂ ਦਾ ਬਹੁਤ ਅਸਰ ਹੈ ਕਿਉਂਕਿ ਉਹਨਾਂ ਦਾ ਖਾਣ ਪੀਣ ਉਹਨਾਂ ਦਾ ਪਹਿਰਾਵਾ ਉਹਨਾਂ ਦੀਆਂ ਇੱਥੋਂ ਤੱਕ ਕਿ ਉਹਨਾਂ ਦੀ ਰੋਜ਼ਾਨਾ ਦੀ ਜੀਵਨ ਸ਼ੈਲੀ ਉੱਤੇ ਵੀ ਬਹੁਤ ਜ਼ਿਆਦਾ ਅਸਰ ਪੈਂਦਾ ਹੈ ਜਿਵੇਂ ਕਿ ਠੰਡਾਂ ਦੇ ਵਿੱਚ ਉਹਨਾਂ ਦੀ ਖੁਰਾਕ ਪੂਰੀ ਬਦਲ ਜਾਂਦੀ ਹੈ ਉਹ ਜ਼ਿਆਦਾ ਗਰਮ ਚੀਜ਼ਾਂ ਦਾ ਸੇਵਨ ਕਰਦੇ ਹਨ ਅਤੇ ਉਸ ਤੋਂ ਬਾਅਦ ਉਹਨਾਂ ਦੀ ਮੱਕੀ ਦੀ ਰੋਟੀ ਸਰਸੋਂ ਦਾ ਸਾਗ ਪ੍ਰਧਾਨ ਹੋ ਜਾਂਦਾ ਹੈ ਘਰਾਂ ਵਿੱਚ ਅਤੇ ਉਹਨਾਂ ਦੇ ਕੱਪੜੇ ਵੀ ਜਿਹੜੇ ਹਨ ਉਹ ਕੋਟੀਆਂ ਸ਼ੋਲ ਅਤੇ ਮੋਟੇ ਸੂਟ ਵਗੈਰਾ ਉਹ ਪਾਉਂਦੇ ਹਨ ਅਤੇ ਕਿਉਂਕਿ ਇੱਥੇ ਜਿਹੜੀ ਮੌਸਮ ਹੈ ਇੱਥੇ ਜਿਹੜੀ ਠੰਡ ਹੈ ਉਹ ਆਲੇ ਦੁਆਲੇ ਨਹਿਰਾਂ ਵੀ ਹਨ ਖੇਤ ਹਨ ਜਿਨ੍ਹਾਂ ਨੂੰ ਪਾਣੀ ਲੱਗਦਾ ਹੈ ਉਸ ਕਰਕੇ ਜਿਹੜੀ ਠੰਡ ਹੈ ਉਹ ਜ਼ਿਆਦਾ ਹੈ ਆਮ ਆਮ ਜ਼ਿਲ੍ਹਿਆਂ ਦੇ ਨਾਲੋਂ ਆਮ ਸਟੇਟਸ ਦੇ ਨਾਲੋਂ ਇਸ ਤੋਂ ਇਲਾਵਾ ਜਦੋਂ ਗਰਮੀਆਂ ਆਉਂਦੀਆਂ ਹਨ ਤਾਂ ਉਹ ਹਲਕੇ ਕੱਪੜੇ ਸੂਤੀ ਕੱਪੜੇ ਪਾ ਕੇ ਖੁਸ਼ ਰਹਿੰਦੇ ਹਨ ਅਤੇ ਉਹ ਹਲਕੀਆਂ ਚੀਜ਼ਾਂ ਖਾਂਦੇ ਹਨ ਅਤੇ ਜਦੋਂ ਬਸੰਤ ਰੁੱਤ ਆਉਂਦੀ ਹੈ ਤਾਂ ਇੱਥੇ ਸਾਰੇ ਪਾਸੇ ਠੰਡ ਜਿਹੜੀ ਹੈ ਉਹ ਘੱਟ ਜਾਂਦੀ ਹੈ ਅਤੇ ਉਸ ਵੇਲੇ ਬਸੰਤ ਰੁੱਤ ਦੇ ਵਿੱਚ ਉਹ ਪਤੰਗ ਉਡਾਉਂਦੇ ਹਨ ਬਸੰਤ ਰੁੱਤ ਦਾ ਜਿਹੜਾ ਹੈਗਾ ਉਹ ਠੰਡ ਦੇ ਕਹਿਰ ਤੋਂ ਬਚਾਅ ਤੋਂ ਬਾਅਦ ਹਲਕੀ ਹਲਕੀ ਨਿੱਘੀ ਧੁੱਪ ਦਾ ਆਨੰਦ ਮਾਣਦੇ ਹਨ ਅਤੇ ਕੱਪੜੇ ਵੀ ਉਹ ਭਾਰੇ ਕੱਪੜਿਆਂ ਤੋਂ ਹਲਕੇ ਹਲਕੇ ਕੋਟੀਆਂ ਸਵੈਟਰ 'ਤੇ ਆ ਜਾਂਦੇ ਹਨ ਅਤੇ ਉਸ ਤੋਂ ਇਲਾਵਾ ਜਦੋਂ ਬਰਸਾਤ ਹੁੰਦੀ ਹੈ ਤਾਂ ਉਹ ਛੱਤਰੀਆਂ ਦੀ ਵਰਤੋਂ ਕਰਦੇ ਹਨ ਤਾਂ ਕਿ ਬਰਸਾਤ ਤੋਂ ਬਚਾਅ ਹੋ ਸਕੇ ਅਤੇ ਇਸ ਤਰ੍ਹਾਂ ਉਹਨਾਂ ਦੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਮੌਸਮਾਂ ਦਾ ਹੈ ਉਹਨਾਂ ਦੇ ਰੋਜ਼ਾਨਾ ਜੀਵਨ 'ਤੇ ਬਹੁਤ ਗਹਿਰਾ ਅਸਰ ਪੈਂਦਾ ਹੈ